ਪੁਰਾਣੇ ਸਮੇਂ ਦੇ ਸਿੱਕਿਆਂ ਜਾਂ ਸਟੈਮਪਾਂ ਦਾ ਵਿੱਦਿਅਕ ਮੁੱਲ ਇਹ ਹੈ ਕਿ ਸਾਨੂੰ ਆਪਣੇ ਪੁਰਾਣੇ ਸਮਿਆਂ 'ਚ ਜੋ ਸਿੱਕੇ ਚਲਦੇ ਸੀ ਜਾਂ ਉ ਉਹ ਕਿਸੇ ਖ਼ਾਸ ਮੌਕੇ 'ਤੇ ਰਿਲੀਜ਼ ਕੀਤੇ ਜਾਂਦੇ ਸੀ ਅਤੇ ਉਹ ਸਮੇਂ ਨੂੰ ਯਾਦ ਰੱਖਣ ਲਈ ਉਹ ਸਿੱਕਿਆਂ ਨੂੰ ਦੇਖ ਕੇ ਸਾਨੂੰ ਉਹ ਯਾਦ ਦਿਲਾਉਂਦੇ ਹੈ